ਗੀਤ ਗਾਉਣਾ ਮੈਨੂੰ ਬਚਪਨ ਤੋਂ ਹੀ ਬਹੁਤ ਪਸੰਦ ਹੈ ਇਸ ਕਰਕੇ ਮੈਂ ਬਚਪਨ ਤੋਂ ਹੀ ਗੀਤ ਗਾ ਰਹੀ ਹਾਂ ਮੈਨੂੰ ਭਜਨ ਗਾਉਣਾ ਬਹੁਤ ਪਸੰਦ ਹੈ ਕਿਉਂਕਿ ਮੈਂ ਦੇਖਦੀ ਆ ਰਹੀ ਹਾਂ ਕਿ ਮੇਰੀ ਦਾਦੀ ਮਾਂ ਅਤੇ ਪਿਤਾ ਜੀ ਭਜਨ ਗਾਉਂਦੇ ਹਨ ਇਸ ਕਰਕੇ ਉਹਨਾਂ ਨਾਲ ਬੈਠ ਕੇ ਜਿਵੇਂ ਭਜਨ ਗਾਉਣਾ ਬਹੁਤ ਪਸੰਦ ਹੈ ਅਤੇ ਸ਼ੁਰੂ ਬਚਪਨ ਤੋਂ ਹੀ ਗਾਉਂਦੀ ਆ ਰਹੀ ਹਾਂ ਮੇਰੇ ਭਜਨ ਮੇਰੇ ਮਨ ਨੂੰ ਬਹੁਤ ਭਾਉਂਦੇ ਹਨ ਜਿਹੜੇ ਭਜਨ ਮੇਰੇ ਮਨ ਨੂੰ ਭਾਉਂਦੇ ਹਨ ਜਾਂ ਗੀਤ ਜਿਹੜੇ ਮੇਰੇ ਮਨ ਨੂੰ ਚੰਗੇ ਲੱਗਦੇ ਹਨ ਅਤੇ ਇਸ ਸੰਸਾਰ ਦੇ ਰਿਲੇਟਿਡ ਹੋਣ ਉਹ ਮੈਂ ਰਿਕਾਰਡ ਕਰਦੀ ਹਾਂ ਅਤੇ ਬਾਕੀਆਂ ਨੂੰ ਸੁਣਾਉਂਦੀ ਹਾਂ ਗੀਤ ਗਾਉਣਾ ਮੇਰਾ ਸਭ ਤੋਂ ਮਨ ਪਸੰਦ ਭਜਨ ਹੈ ਸਤਿਅਮ ਸ਼ਿਵਮ ਸੁੰਦਰਮ ਧੰਨਵਾਦ